ਮੈਂ ਨਿੱਜੀ ਤੌਰ 'ਤੇ ਇਹ ਮੰਨਦਾ ਹਾਂ ਕਿ ਬੱਚਿਆਂ ਦੇ ਲਈ ਪੇਂਟਿੰਗ ਸ਼ੁਰੂ ਕਰਨ ਦੀ ਕੋਈ ਨਿਯਮਤ ਉਮਰ ਨਹੀਂ ਹੈ ਜਦੋਂ ਵੀ ਕੋਈ ਵੀ ਬੱਚਾ ਆਪਣੇ ਹੱਥ ਦੇ ਵਿੱਚ ਅੱਛੀ ਤਰ੍ਹਾਂ ਉਸਦੇ ਹੱਥ ਦੀ ਗ੍ਰਿਪ ਅੱਛੀ ਹੋ ਜੇ ਕਿਸੇ ਵੀ ਪੈਨਸਿਲ ਨੂੰ ਲੈ ਕੇ ਕਿਸੇ ਵੀ ਬ੍ਰਸ਼ ਨੂੰ ਲੈ ਕੇ ਤਾਂ ਉਹ ਜਾਂ ਕਿਸੇ ਵੀ ਸਕੈਚ ਨੂੰ ਲੈ ਕੇ ਤਾਂ ਉਸ ਦਿਨ ਤੋਂ ਉਹ ਪੇਂਟਿੰਗ ਬਣਾਉਣੀ ਸ਼ੁਰੂ ਕਰ ਸਕਦਾ ਹੈ ਜਾਂ ਸਿੱਖਣੀ ਸ਼ੁਰੂ ਕਰ ਸਕਦਾ ਹੈ ਕਿਉਂਕਿ ਪੇਂਟਿੰਗ ਦੇ ਵਿੱਚ ਆਪਣੇ ਹੱਥਾਂ ਦਾ ਹੀ ਸਾਰਾ ਯੋਗਦਾਨ ਹੈ ਜੇਕਰ ਤੁਹਾਡੇ ਹੱਥਾਂ ਦੀ ਗ੍ਰਿਪ ਹੀ ਸਹੀ ਨਹੀਂ ਹੋਏਗੀ ਜੇਕਰ ਤੁਹਾਨੂੰ ਸਕੈਚ ਹੀ ਫੜਨਾ ਨਹੀਂ ਆਏਗਾ ਜਾਂ ਜੇਕਰ ਤੁਹਾਨੂੰ ਪੇਂਟ ਬਰਸ਼ ਹੀ ਫੜਨਾ ਨਹੀਂ ਆਏਗਾ ਤਾਂ ਤੁਸੀਂ ਕੀ ਹੀ ਪੇਂਟਿੰਗ ਬਣਾਓਗੇ ਤਾਂ ਮੈਂ ਸਮਝਦਾ ਹਾਂ ਕਿ ਬੱਚਾ ਜਦੋਂ ਵੀ ਤੁਹਾਡੇ ਬੱਚੇ ਆਪਣਾ ਪੇਂਟ ਬਰਸ਼ ਜਾਂ ਸਕੈਚ ਜਾਂ ਕਰਿਓਨ ਨੂੰ ਅੱਛੀ ਤਰ੍ਹਾਂ ਹੈਂਡਲ ਕਰਨ ਲੱਗ ਗਏ ਅੱਛੀ ਤਰ੍ਹਾਂ ਗਰਿਪ ਕਰਨ ਲੱਗ ਗਏ ਅੱਛੀ ਤਰ੍ਹਾਂ ਉਹਨਾਂ ਦੇ ਹੱਥ ਵੀ ਦੇ ਵਿੱਚ ਪਕੜ ਬੈਠਣ ਲੱਗ ਗਈ ਜੋ ਉਹਨਾਂ ਨੇ ਦਿਮਾਗ ਤੋਂ ਸੋਚਿਆ ਉਹ ਉਹਨਾਂ ਨੇ ਬਣਾਤਾ ਜੇ ਉਹਨਾਂ ਨੇ ਲਾਈਨ ਮਾਰਨੀ ਆ ਤਾਂ ਉਹਨਾਂ ਨੇ ਲਾਈਨ ਮਾਰਤੀ ਜੇ ਉਹਨਾਂ ਨੇ ਇੱਕ ਘਰ ਬਣਾਉਣਾ ਸੀ ਤਾਂ ਉਹਨਾਂ ਤੋਂ ਘਰ ਬਣ ਗਿਆ ਅਤੇ ਜੇਕਰ ਉਹਨਾਂ ਦੀ ਬਰਸ਼ ਜਾਂ ਆਪਣੀ ਸਕੈਚ ਕੋਈ ਇੱਧਰ ਉੱਧਰ ਨਹੀਂ ਜਾ ਰਹੇ ਤਾਂ ਉਹ ਪੇਂਟਿੰਗ ਬਣਾ ਸਕਦੇ ਹਨ ਅਤੇ ਸਿੱਖ ਸਕਦੇ ਹਨ